ਮੇਰੇ ਪਾਸ ਮੇਰੇ ਪਸੰਦ ਦੀਆਂ ਕਿਤਾਬਾਂ ਤਾਂ ਬਹੁਤ ਹਨ ਪਰ ਕੁਝ ਕਿਤਾਬਾਂ ਜਿਵੇਂ ਕਿ ਗੁਰੂ ਨਾਨਕ ਦੇਵ ਜੀ ਦੀਆਂ ਜਨਮ ਸਾਖੀਆਂ ਉਹਨਾਂ ਦੇ ਬਚਪਨ ਦੀਆਂ ਖੇਡਾਂ ਉਹ ਮੈਨੂੰ ਬਹੁਤ ਪਸੰਦ ਹਨ ਗੁਰੂ ਨਾਨਕ ਦੇਵ ਜੀ ਨੇ ਛੋਟੇ ਹੁੰਦਿਆਂ ਹੀ ਜਦ ਉਹਨਾਂ ਨੂੰ ਪਾਂਧੇ ਕੋਲ ਭੇਜਿਆ ਗਿਆ ਤਾਂ ਉਹ ਪਾਂਧੇ ਨੂੰ ਪੜ੍ਹਾ ਆਏ ਉਹ ਤਾਂ ਖੁਦ ਜਾਣੀ ਜਾਣ ਸਨ ਉਹਨਾਂ ਨੂੰ ਤਾਂ ਬਹੁਤ ਰੱਬੀ ਰੱਬੀ ਨੂਰ ਸੀ ਉਹਨਾਂ ਵਿੱਚ ਹੋਰ ਇਸੇ ਤਰ੍ਹਾਂ ਜਦੋਂ ਉਹਨਾਂ ਨੂੰ ਵੱਡੇ ਹੋਏ ਤਾਂ ਸੱਚਾ ਸੌਦਾ ਕਰਨ ਲਈ ਪਿਤਾ ਜੀ ਨੇ ਵੀਹ ਰੁਪਏ ਦੇ ਕੇ ਭੇਜਿਆ ਤਾਂ ਉਹ ਸਾਧੂਆਂ ਨੂੰ ਲੰਗਰ ਛਕਾ ਆਏ ਇਹ ਲੰਗਰ ਦੀ ਪ੍ਰਥਾ ਉਦੋਂ ਤੋਂ ਹੀ ਸ਼ੁਰੂ ਹੋਈ ਜਦੋਂ ਗੁਰੂ ਨਾਨਕ ਦੇਵ ਜੀ ਨੇ ਵੀਹ ਰੁਪਏ ਦੇ ਨਾਲ ਸੱਚਾ ਸੌਦਾ ਕਰਕੇ ਭੁੱਖੇ ਸਾਧੂਆਂ ਨੂੰ ਲੰਗਰ ਛਕਾਇਆ ਸੀ ਇਸ ਕਰਕੇ ਇਹ ਕਹਾਣੀਆਂ ਮੈਨੂੰ ਬਹੁਤ ਚੰਗੀਆਂ ਲੱਗਦੀਆਂ ਹਨ ਅਤੇ ਮੈਂ ਆਪਣੇ ਛੋਟੇ ਬੱਚਿਆਂ ਨੂੰ ਪੋਤਰੇ ਪੋਤਰਿਆਂ ਨੂੰ ਵੀ ਇਹ ਕਹਾਣੀਆਂ ਸੁਣਾਉਂਦੀ ਹਾਂ ਕਿਉਂਕਿ ਇਹਨਾਂ ਤੋਂ ਸਿੱਖਿਆਵਾਂ ਮਿਲਦੀਆਂ ਹਨ ਚੰਗੀ ਸਿੱਖਿਆ ਮਿਲਦੀ ਹੈ ਬੱਚਿਆਂ ਵਿੱਚ ਵੀ ਇਹੋ ਜਿਹੀਆਂ ਆਦਤਾਂ ਆਉਣੀਆਂ ਚਾਹੀਦੀਆਂ ਹਨ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਬਾਰੇ ਵੀ ਮੇਰੇ ਪਾਸ ਕਿਤਾਬਾਂ ਹਨ ਗੁਰੂ ਗੋਬਿੰਦ ਸਿੰਘ ਜੀ ਜਦ ਛੋਟੇ ਹੀ ਸਨ ਤਾਂ ਉਹਨਾਂ ਨੂੰ ਜੰਗਾਂ ਲੜਨ ਦਾ ਸ਼ੌਂਕ ਸੀ ਆਪਣੇ ਦੋਸਤਾਂ ਦੀਆਂ ਦੋ ਦੋ ਟੋਲੀਆਂ ਬਣਾ ਲੈਂਦੇ ਸਨ ਅਤੇ ਲੜਾਈਆਂ ਕਰਿਆ ਕਰਦੇ ਸਨ ਇਹ ਵੱਡੇ ਹੋ ਕੇ ਉਹਨਾਂ ਦੇ ਕੰਮ ਆਈਆਂ ਉਹਨਾਂ ਨੇ ਬਹੁਤ ਜੰਗਾਂ ਲੜੀਆਂ ਅਤੇ ਜੰਗਾਂ ਵਿੱਚ ਸਫਲਤਾ ਪ੍ਰਾਪਤ ਕੀਤੀ ਇਸ ਕਰਕੇ ਮੈਨੂੰ ਇਹ ਕਿਤਾਬਾਂ ਤਾਂ ਹੀ ਚੰਗੀਆਂ ਲੱਗਦੀਆਂ ਹਨ ਇਹਨਾਂ ਬਾਰੇ ਮੈਂ ਆਪਣੇ ਬੱਚਿਆਂ ਨੂੰ ਵੀ ਸਿੱਖਿਆ ਦਿੰਦੀ ਹਾਂ ਕਿ ਤੁਸੀਂ ਵੀ ਉਹਨਾਂ ਗੁਰੂਆਂ ਵਰਗੇ ਬਣੋ ਤੁਸੀਂ ਵੀ ਉਹਨਾਂ ਦੀ ਤਰ੍ਹਾਂ ਚੰਗੀਆਂ ਆਦਤਾਂ ਪਾਓ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰੋ ਧੰਨਵਾਦ